ਸਾਡੇ ਰਾਜ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿਨ੍ਹਾਂ ਵਿੱਚੋਂ ਹਰਿਮੰਦਰ ਸਾਹਿਬ ਦੁਰਗਿਆਨਾ ਮੰਦਿਰ ਦੇ ਵਿਦਲਾਮ ਮੰਦਿਰ ਕਾਲੀ ਮਾਤਾ ਦਾ ਮੰਦਿਰ ਰਾਮ ਤੀਰਥ ਪੀਰ ਮੁਹੰਮਦ ਦੀ ਦਰਗਾਹ ਤੇ ਚਰਚ ਵੀ ਬਹੁਤ ਸਾਰੀਆਂ ਹਨ ਇਹਨਾਂ ਵਿੱਚੋਂ ਮੈਨੂੰ ਸਭ ਤੋਂ ਜਿਆਦਾ ਮੈਂ ਮੰਨਦੀ ਤੇ ਹਿੰਦੂ ਧਰਮ ਦੇ ਨਾਲ ਹੁਣ ਮੈਂ ਦਰਗਿਆਨਾ ਮੰਦਿਰ ਵੀ ਜਾਂਨੀ ਹਾਂ ਪਰ ਮੈਨੂੰ ਸਭ ਤੋਂ ਜ਼ਿਆਦਾ ਜਾਣਾ ਮੈਨੂੰ ਉੱਥੇ ਸ਼ਹੀਦਾਂ ਸਾਹਿਬ ਬਹੁਤ ਸੋਹਣਾ ਚੰਗਾ ਲੱਗਦਾ ਹਨ ਸ਼ਹੀਦਾਂ ਸਾਹਿਬ ਜਾ ਕੇ ਉੱਥੇ ਮੈਨੂੰ ਮਨ ਦੀ ਬੜੀ ਹੀ ਸ਼ਾਂਤੀ ਮਿਲਦੀ ਹੈ ਉੱਥੇ ਜਾ ਕੇ ਮੈਂ ਘੱਟ ਤੋਂ ਘੱਟ ਆ ਇੱਕ ਮਹੀਨੇ ਵਿੱਚ ਮੈਂ ਉੱਥੇ ਚਾਰ ਪੰਜ ਵਾਰੀ ਤਾਂ ਜਾ ਕੇ ਹੀ ਆਉਂਦੀ ਹਾਂ ਉਸ ਵਿੱਚ ਜਾਣਾ ਮੈਨੂੰ ਇਸ ਕਰਕੇ ਚੰਗਾ ਲੱਗਦਾ ਕਿ ਉੱਥੇ ਜਾ ਕੇ ਜਦੋਂ ਅਸੀਂ ਸ਼ਬਦ ਸੁਣਦੇ ਹਾਂ ਤਾਂ ਉਹਦੇ ਨਾਲ ਮਨ ਨੂੰ ਇੰਨੀ ਕੁ ਜ਼ਿਆਦਾ ਸ਼ਾਂਤੀ ਮਿਲਦੀ ਹੈ ਜਦੋਂ ਮੈਂ ਸ਼ਹੀਦਾਂ ਸਾਹਿਬ ਜਾਂਦੀ ਹਾਂ ਜੇ ਮੈਨੂੰ ਕੋਈ ਵੀ ਦੁੱਖ ਰੋਗ ਹੋਵੇ ਉੱਥੋਂ ਦੀ ਜੋਤ ਲੈ ਕੇ ਉੱਥੋਂ ਦਾ ਘਿਓ ਲੈ ਕੇ ਮੈਨੂੰ ਮਲਣ ਨਾਲ ਇੱਦਾਂ ਲੱਗਦਾ ਹੈ ਜਿਵੇਂ ਬਾਬਾ ਜੀ ਨੇ ਆਪਣਾ ਆਸ਼ੀਰਵਾਦ ਮੇਰੇ ਸਿਰ 'ਤੇ ਉੱਤੇ ਰੱਖ ਦਿੱਤਾ ਹੋਵੇ ਉੱਥੇ ਜਾ ਕੇ ਮੈਂ ਜਦੋਂ ਆਪਣੇ ਬੇਟੇ ਲਈ ਵੀ ਮੰਗਦੀ ਹਾਂ ਜਾਂ ਮੈਂ ਆਪਣੇ ਘਰ ਵਾਲੇ ਲਈ ਜਾ ਮੈਂ ਲੋਕਾਂ ਲਈ ਵੀ ਮੰਗਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਸ਼ਹੀਦਾਂ ਸਾਹਿਬ ਜਾ ਕੇ ਇੱਕ ਵਾਰੀ ਮੇਰੇ ਗੋਡੇ ਦੇ ਉੱਤੇ ਇੰਨੀ ਕੁ ਜ਼ਿਆਦਾ ਸੱਟ ਲੱਗੀ ਮੇਰੇ ਕੋਲ ਚੱਲਿਆ ਨਹੀਂ ਜਾਂਦਾ ਪਿਆ ਸੀ ਤਾਂ ਮੈਂ ਸ਼ਹੀਦਾਂ ਸਾਹਿਬ ਜਾ ਕੇ ਉੱਥੋਂ ਦਾ ਘਿਓ ਲਿਆ ਕੇ ਜਦੋਂ ਮੈਂ ਇੱਕ ਵਾਰੀ ਹੀ ਆਪਣੇ ਗੋਡੇ ਨੂੰ 'ਤੇ ਮਲਿਆ ਅਤੇ ਮੈਨੂੰ ਇੱਦਾਂ ਲੱਗ ਗਿਆ ਜਿਵੇਂ ਮੇਰਾ ਗੋਡਾ ਬਿਲਕੁਲ ਠੀਕ ਹੋ ਗਿਆ ਹੈ ਅਤੇ ਮੈਂ ਬਿਲਕੁਲ ਚੰਗੀ ਤਰ੍ਹਾਂ ਚੱਲਣ ਲੱਗ ਪਈ ਹਾਂ ਇਸ ਦੇ ਨਾਲ ਮੈਨੂੰ ਚੱਲਣ ਦੇ ਨਾਲ ਮੈਨੂੰ ਇਸ ਤਰ੍ਹਾਂ ਦਾ ਉੱਥੇ ਜਾ ਕੇ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਬਾਬਾ ਜੀ ਦੇ ਸਾਹਮਣੇ ਬੈਠੀ ਹਾਂ ਅਤੇ ਬਾਬਾ ਜੀ ਮੇਰੀ ਸਾਰੀਆਂ ਹੀ ਮੁਰਾਦਾਂ ਪੂਰੀਆਂ ਕਰਦੇ ਹਨ ਇੱਕ ਵਾਰੀ ਜਦੋਂ ਮੇਰਾ ਮੁੰਡਾ ਹੋਣਾ ਸੀ ਤਾਂ ਮੈਂ ਉਦੋਂ ਸ਼ਹੀਦਾਂ ਸਾਹਿਬ ਬਾਬਾ ਜੀ ਦੇ ਗੁਰਦੁਆਰੇ ਦੇ ਉੱਤੇ ਗਈ ਅਤੇ ਮੈਂ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਸਹੀ ਸਲਾਮਤ ਬਾਕੀ ਜੋਵਾ ਜਿਹੜਾ ਵੀ ਜੀਅ ਜਾਵੇ ਪਰ ਆਵੇ ਸਹੀ ਸਲਾਮਤ ਅਤੇ ਬਾਬਾ ਜੀ ਨੇ ਉਸੇ ਵਕਤ ਮੇਰੀ ਮੁਰਾਦ ਪੂਰੀ ਕੀਤੀ ਜਦੋਂ ਮੇਰੇ ਮੁੰਡੇ ਦਾ ਕਦੇ ਮੈਨੂੰ ਕੋਈ ਮੁਸ਼ਕਿਲ ਹੁੰਦੀ ਆ ਅਤੇ ਮੈਂ ਬਾਬਾ ਜੀ ਅੱਗੇ ਪ੍ਰਾਥਨਾ ਕਰਦੀ ਹਨ ਕਿ ਬਾਬਾ ਜੀ ਮੈਨੂੰ ਐਹ ਚੀਜ਼ ਦੀ ਮੁਸ਼ਕਿਲ ਹੈ ਜਿੰਨਾ ਕਈ ਵਾਰੀ ਅਸੀਂ ਆਪਣੇ ਮਾਂ ਬਾਪ ਅਗੇ ਵੀ ਨਹੀਂ ਕਦੇ ਭਗਵਾਨ ਦੇ ਭਗਵਾਨ ਹੁੰਦਾ ਉਹੀ ਸਾਰਿਆਂ ਨਾਲ ਮਾਂ ਪਿਓ ਹੁੰਦਾ ਹੈ ਇਸ ਕਰਕੇ ਮੈਂ ਬਾਬਾ ਜੀ ਅੱਗੇ ਜਦੋਂ ਵੀ ਕੋਈ ਮੁਰਾਦ ਮੰਗਣ ਲਈ ਜਾਂਦੀ ਹਾਂ ਜੋ ਬਾਬਾ ਜੀ ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਹਨ ਅਤੇ ਮੈਨੂੰ ਉੱਥੇ ਬਹਿ ਕੇ ਕੀਰਤਨ ਕਰਨਾ ਮੈਨੂੰ ਉੱਥੇ ਬਹਿ ਕੇ ਸੇਵਾ ਕਰਨੀ ਉਹ ਬਹੁਤ ਹੀ ਚੰਗੀ ਲੱਗਦੀ ਹੈ ਉਹਨਾਂ ਦੇ ਜਿਹੜੇ ਇੰਨੇ ਸਾਰੇ ਲੋਕ ਸੇਵਾਦਾਰ ਸੇਵਾ ਕਰਦੇ ਹਨ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੂੰ ਸੇਵਾ ਉਹਨਾਂ ਨੂੰ ਇਸੇ ਕਰਕੇ ਕਰਦੇ ਹਨ ਕਿਉਂਕਿ ਉਹਨਾਂ ਦੀਆਂ ਉੱਥੇ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਨੂੰ ਸ਼ਾਂਤੀ ਮਿਲਦੀ ਕੀਰਤਨ ਸੁਣਨ ਸਮੇਂ ਮੈਨੂੰ ਇੰਨਾ ਕੁ ਜ਼ਿਆਦਾ ਉੱਥੇ ਜਾ ਕੇ ਆਨੰਦ ਮਿਲਦਾ ਹੈ ਕਿ ਜਿਸ ਦੀ ਕੋਈ ਗੱਲ ਹੀ ਨਹੀਂ ਹੈ